ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਨਾ ਸਵੀਗੀ ਤੋਂ ਦੋ ਬਰਗਰ ਅਤੇ ਦੋ ਨਿਊਡਸ ਪਲੇਟਸ ਔਡਰ ਕੀਤੀਆਂ ਸੀਗੀਆਂ ਅਤੇ ਪਲੀਜ਼ ਤੁਸੀਂ ਬਰਾੜ ਰੈਸਟੋਰੈਂਟ ਤੋਂ ਪਿੱਕ ਕਰਕੇ ਅਤੇ ਮੈਨੂੰ ਸੈਂਟਰ ਯੂਨੀਵਰਸਿਟੀ ਪੰਜਾਬ ਘੁੱਦਾ ਤੋਂ ਪਹੁੰਚਦਾ ਕਰ ਦਿਓ ਗੇਟ 'ਤੇ ਆ ਕੇ ਸਕਿਓਰਟੀ ਗਾਰਡ ਤੋਂ ਬੋਆਇਸ ਹੋਸਟਲ ਦਾ ਐਡਰੈਸ ਪੁੱਛ ਲਿਓ ਅਤੇ ਉਹ ਤੁਹਾਨੂੰ ਦੱਸ ਦੇਣਗੇ ਬੋਆਇਸ ਹੋਸਟਲ ਆ ਕੇ ਅਤੇ ਸੈਕਿੰਡ ਫਲੋਰ 'ਤੇ ਆ ਜਾਇਓ ਸੈਕਿੰਡ ਫਲੋਰ 'ਤੇ ਰੂਮ ਨੰਬਰ ਦੋ ਸੌ ਤਰਤਾਲੀ ਵਿੱਚ ਬੈਠਾ ਹਾਂ ਮੈਂ ਹਾਂਜੀ ਤਾਂ ਕਿ ਥੋੜ੍ਹਾ ਜਿਹਾ ਜਲਦੀ ਕਰ ਲਿਓ ਜੇ ਇੱਦਾਂ ਨਾ ਵੀ ਖਾਣਾ ਠੰਡਾ ਵਗੈਰਾ ਹੋ ਜਾਂਦਾ ਨਾ ਸੋ ਪਲੀਜ਼